ਅਸੀਂ ਕਈ ਕਿਸਮ ਦੇ ਪੌਦੇ ਅਤੇ ਵੇਲਾਂ ਉਗਾਉਂਦੇ ਹਨ ਪੌਦਿਆਂ ਵਿੱਚ ਜ਼ਿਆਦਾਤਰ ਫਲਦਾਰ ਅਤੇ ਛਾਂ ਦਾਰ ਪੌਦੇ ਉਗਾਉਂਦੇ ਹਨ ਮੇਰੇ ਵੱਲੋਂ ਦੋਨੋਂ ਪ੍ਰਕਾਰ ਦੇ ਪੌਦੇ ਉਗਾਏ ਜਾਂਦੇ ਹਨ ਫਲਦਾਰ ਪੌਦਿਆਂ ਵਿੱਚ ਅੰਬ ਜਾਮੁਨ ਅਤੇ ਅਮਰੂਦ ਲਗਾਠਾਂ ਆਦਿ ਸ਼ਾਮਿਲ ਹਨ ਇਸ ਤੋਂ ਇਲਾਵਾ ਮੇਰੇ ਵੱਲੋਂ ਗੁਣਾਂ ਨਾਲ ਭਰਪੂਰ ਪੌਦੇ ਸੁਹੰਜਣਾ ਅਤੇ ਕੜੀ ਪੱਤਾ ਵੀ ਲਗਾਏ ਜਾਂਦੇ ਹਨ ਮੇਰੇ ਵੱਲੋਂ ਨਿੰਬੂ ਅਤੇ ਗਲਗਲਾਂ ਦਾ ਵੀ ਪੌਦਾ ਲਗਾਇਆ ਗਿਆ ਹੈ ਜੇਕਰ ਗੱਲ ਕਰੀਏ ਛਾਂ ਦਾਰ ਪੌਦਿਆਂ ਦੀ ਤਾਂ ਮੇਰੇ ਵੱਲੋਂ ਟਾਹਲੀ ਡੇਕ ਨਿੰਮ ਅਤੇ ਬੋਹੜ ਆਦਿ ਦੀ ਵੀ ਲਗਾਏ ਜਾਂਦੇ ਹਨ ਵੇਲਾਂ ਵਿੱਚੋਂ ਗਰਮੀਆਂ ਦੇ ਸੀਜ਼ਨ ਵਿੱਚ ਘੀਆ ਕੱਦੂ ਕਰੇਲੇ ਹਲਵਾ ਕੱਦੂ ਅਤੇ ਖੀਰੇ ਆਦਿ ਦੀਆਂ ਵੇਲਾਂ ਲਗਾਈਆਂ ਜਾਂਦੀਆਂ ਹਨ ਅਤੇ ਸਰਦੀਆਂ ਵਿੱਚ ਵੀ ਮਟਰ ਆਦਿ ਦੀਆਂ ਵੇਲਾਂ ਲਗਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਫੁੱਲਾਂ ਦੀਆਂ ਵੇਲਾਂ ਵੀ ਲਗਾਈਆਂ ਜਾਂਦੀਆਂ ਹਨ